ਮੇਰੀ ਮਨਪਸੰਦ ਬਾਈਕ ਬੁਲਟ ਹੈ ਮੈਂ ਬੁਲਟ ਦੇ ਸਾਰੇ ਮੋਡਲ ਪਸੰਦ ਕਰਦਾਂ ਜਿੱਦਾਂ ਕਿ ਹੋ ਗਿਆ ਬੁਲਟ ਹਿਮਾਲਿਆ ਹੋ ਗਿਆ ਬੁਲਟ ਸਟੈਂਡਰਡ ਹੋ ਗਿਆ ਬੁਲਟ ਕਲਾਸਿਕ ਹੋ ਗਿਆ ਅਤੇ ਮੇਰੇ ਕੋਲ ਆਪਣੀ ਇੱਕ ਬੁਲਟ ਸਟੈਂਡਰਡ ਬਾਈਕ ਹੈ ਜੋ ਕਿ ਮੈਂ ਪੂਰੀ ਐਂ ਘੈਂਟ ਲਿਸ਼ਕਾ ਕੇ ਰੱਖੀ ਹੋਈ ਆ ਬਾਈਕਿੰਗ ਜੇਕਰ ਤੁਸੀਂ ਬਾਈਕਿੰਗ ਦੇ ਯਾਤਰਾਵਾਂ ਦੀ ਗੱਲ ਕਰੋਗੇ ਤਾਂ ਸਭ ਤੋਂ ਚੀਪ ਅਤੇ ਆਰਾਮਦਾਇਕ ਬਾਈਕ ਬੁਲਟ ਹੀ ਹੈ ਕਿਉਂਕਿ ਲੌਂਗ ਸਰਫ ਸਫਰ ਲਈ ਪਹਾੜਾਂ 'ਤੇ ਯਾਤਰਾ ਕਰਨ ਲਈ ਬੁਲਟ ਇੱਕਦਮ ਪਰਫੈਕਟ ਹੈ ਜਿੰਨੀ ਮਰਜ਼ੀ ਚੜ੍ਹਾਈ ਹੋਵੇ ਜਿੰਨੇ ਮਰਜ਼ੀ ਯੂ ਟਰਨ ਹੋਣ ਵੀ ਸ਼ੇਪ ਟਰਨ ਹੋਣ ਇਹ ਬਿਨਾਂ ਰੋਕ ਟੋਕ ਉੱਤੇ ਚੜ੍ਹ ਜਾਂਦੀ ਹੈ ਅਤੇ ਇਹਦੇ ਨਾਲ ਕਿਸੇ ਨੂੰ ਕੋਈ ਦਿੱਕਤ ਨਹੀਂ ਆਉਂਦੀ ਨਾ ਇਹਨੂੰ ਕੋਈ ਰਾਹ 'ਚ ਪ੍ਰੋਬਲਮ ਆਉਂਦੀ ਹੈ ਬਸ ਇੱਕ ਵਾਰੀ ਤੁਸੀਂ ਇੱਥੋਂ ਜਦੋਂ ਤੁਰਨ ਵੇਲੇ ਚੈੱਕ ਕਰਾ ਕੇ ਜਾਓ ਮੈਂ ਆਪਣੇ ਬੁਲਟ 'ਤੇ ਕਾਫੀ ਯਾਤਰਾਵਾਂ ਕੀਤੀਆਂ ਹਨ ਬਹੁਤ ਲੰਬੀਆਂ ਲੰਬੀਆਂ ਯਾਤਰਾਵਾਂ ਕੀਤੀਆਂ ਹਨ ਅਤੇ ਆਈ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਵੀ ਇਹ ਯਾਤਰਾਵਾਂ ਕਰੋਗੇ